ਹਾਂਜੀ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਅਸੀਂ ਵਧੀਆ ਤੋਂ ਵਧੀਆ ਜਿਹੜਾ ਨਵਾਂ ਮੋਡਲ ਚੱਲਿਆ ਉਸ ਤਰ੍ਹਾਂ ਦੇ ਗਹਿਣੇ ਬਣਾ ਦਾਂਗੇ ਬਾਕੀ ਤੁਸੀਂ ਡਿਜ਼ਾਈਨ ਦੱਸ ਦਿਓ ਜੇ ਹਾਂਜੀ ਬਾਕੀ ਡਿਜ਼ਾਈਨ ਆ ਜਿਵੇਂ ਪਿੱਪਲ ਪੱਤੀ ਹੋ ਗੀ ਤੇ ਹੋਰ ਵੱਖ ਵੱਖ ਤਰ੍ਹਾਂ ਦੇ ਟਿੱਕਾ ਸੈੱਟ ਹੋ ਗਿਆ ਤੇ ਹਾਂ ਝਾਂਜਰਾਂ ਵਗੈਰਾ ਹੋ ਗੀਆਂ ਚਾਂਦੀ ਦੀਆਂ ਸੋਨੇ ਦੀਆਂ ਵਗੈਰਾ ਵਗੈਰਾ ਦੇ ਅਲੱਗ ਅਲੱਗ ਡਿਜ਼ਾਈਨ ਐ ਆਪਣੇ ਕੋਲ਼ ਟਿੱਕਾ ਹੋ ਗਿਆ ਚੂੜੀਆਂ ਹੋ ਗੀਆਂ ਅੰਗੂਠੀਆਂ ਹੋ ਗੀਆਂ ਹਾਂਜੀ ਕੋਈ ਗੱਲ ਨੀ ਬਣਾਦਾਂਗੇ ਹਾਂਜੀ ਕੋਈ ਗੱਲ ਨੀ ਹਾਂਜੀ ਹਾਂਜੀ ਕੋਈ ਗੱਲ ਨੀ ਬਣਾਦਾਂਗੇ ਹਾਂਜੀ ਕੋਈ ਗੱਲ ਨੀ ਬਣਾਦਾਂਗੇ ਹਾਂਜੀ ਅੱਜ ਕੱਲ੍ਹ ਜਿਹੜਾ ਰੇਟ ਚੱਲਦਾ ਅਸੀਂ ਓਹੀ ਦੱਸਾਂਗੇ ਵੀ ਜ਼ਿਆਦਾ ਦੱਸਣ ਦੀ ਆਪਾਂ ਨੂੰ ਲੋੜ ਈ ਨੀ ਐ ਤੁਸੀਂ ਸਾਡੇ ਪਹਿਲਾਂ ਆਲ਼ੇ ਵੀ ਗਾਹਕ ਓਂ ਅਸੀਂ ਜ਼ਿਆਦਾ ਰੇਟ ਨੀ ਲਾਂਦੇ ਗੇ ਤੇ ਅੱਜ ਕੱਲ੍ਹ ਦਾ ਰੇਟ ਤਰਾਸੀ ਹਜ਼ਾਰ ਨੂੰ ਸੋਨਾ ਐ ਜੀ ਹਾਂਜੀ ਬਾਕੀ ਤੁਹਾਡੀ ਮੈਰਿਜ ਕਦੋਂ ਆਂ ਜਾਂ ਤੁਹਾਨੂੰ ਕਦੋਂ ਤੱਕ ਵੀ ਸੋਨਾ ਚਾਈਦਾ ਹਾਂਜੀ ਕੋਈ ਗੱਲ ਨੀ ਆਪਾਂ ਡਿਜ਼ਾਈਨ ਤੁਸੀਂ ਸਿਲੈਕਟ ਕਰ ਲਿਓ ਜੇ ਤੇ ਆਪਾਂ ਵੀ ਡਿਜ਼ਾਈਨ ਬਣਾਕੇ ਥੋਨੂੰ ਤਿਆਰ ਕਰਕੇ ਦੇਵਾਂਗੇ ਹਾਂਜੀ ਕੋਈ ਗੱਲ ਨੀ ਤੁਸੀਂ ਕੱਲ ਆਂ ਜਿਓ ਜੇ ਤੇ ਆਪਾਂ ਓਦਾਂ ਦਾ ਡਿਜ਼ਾਈਨ ਬਣਾਦਾਂਗੇ ਹਾਂਜੀ ਤੁਸੀਂ ਜੇ ਜ਼ਿਆਦਾ ਵੀ ਮਤਲਬ ਕਿ ਗਹਿਣੇ ਬਨਵਾਣੇ ਆ ਤੇ ਓਹਦੇ ਹਿਸਾਬ ਨਾਲ਼ ਲੱਖ ਦੋ ਲੱਖ ਰੁਪਈਆ ਧੋਨੂੰ ਸਾਈ ਦੇਣੀ ਪੈਣੀ ਆ ਹਾਂਜੀ ਬਾਕੀ ਜਦੋਂ ਥੋਡੇ ਗਹਿਣੇ ਤਿਆਰ ਹੋ ਗੇ ਉਸ ਤੋਂ ਬਾਅਦ ਬਾਕੀ ਜਿਹੜੀ ਪੇਮੈਂਟ ਰਹਿੰਦੀ ਐ ਉਹ ਹਾਂਜੀ ਹਾਂਜੀ ਠੀਕ ਐ ਜੀ ਅਸੀਂ ਗਹਿਣੇ ਤੇ ਵਧੀਆ ਤਿਆਰ ਕਰਕੇ ਦੇਵਾਂਗੇ ਬਾਕੀ ਥੋਡੇ ਡਿਜ਼ਾਈਨ ਤੇ ਐ ਜਿਵੇਂ ਦਾ ਤੁਸੀਂ ਡਿਜ਼ਾਈਨ ਕਵੋਂਗੇ ਓਦਾਂ ਦਾ ਈ ਤਿਆਰ ਕਰਾਂਗੇ ਹਾਂਜੀ ਬਾਕੀ ਥੋਡੇ ਹਸਬੈਂਡ ਲਈ ਤੁਸੀਂ ਕਹਿੰਦੇ ਸੀ ਨਾ ਵੀ ਅੰਗੂਠੀ ਬਨਵਾਣੀ ਆ ਆਪਣੇ ਕੋਲ਼ ਘੜੀ ਵੀ ਹੈਗੀ ਬਹੁਤ ਵਧੀਆ ਡਿਜ਼ਾਈਨ ਆਏ ਆ ਘੜੀਆਂ ਦੇ ਹਾਂਜੀ ਕੜੇ ਦੇ ਵੀ ਬਹੁਤ ਸਾਰੇ ਡਿਜ਼ਾਈਨ ਆਏ ਆ ਘੜੀਆਂ ਦੇ ਹੋ ਗੇ ਅਲੱਗ ਅਲੱਗ ਚੇਨ ਹੋ ਗੀ ਹਾਂਜੀ ਠੀਕ ਐ ਜੀ